ਬਿਲਕੁਲ ਜੀ ਕਟਿੰਗ ਅਤੇ ਬੀਜਾਂ ਤੋਂ ਪੌਦਿਆਂ ਦਾ ਜਿਹੜਾ ਪ੍ਰਸਾਰ ਹੈਗਾ ਨਾ ਉਹ ਬਹੁਤ ਕਰ ਸਕਦੇ ਹਾਂ ਆਪਾਂ ਜਿਵੇਂ ਹੈ ਨਾ ਆਪਾਂ ਕਟਿੰਗ ਰਾਹੀਂ ਕੀ ਹੈਗਾ ਕਟਿੰਗ ਨਾਲ ਕੀ ਆ ਜਿਹੜਾ ਨਾ ਕਟਿੰਗ ਕਰਕੇ ਜਿਹੜਾ ਨਵਾਂ ਪੌਦਾ ਅਤੇ ਆਹਾ ਪੈਦਾ ਹੁੰਦਾ ਹੈਗਾ ਹੈ ਨਾ ਜਿਵੇਂ ਹੁਣ ਅੱਜ ਕੱਲ੍ਹ ਜਿਹੜਾ ਗ ਗਰਮੀ ਦਾ ਜਿਹੜਾ ਮੌਸਮ ਚੱਲ ਰਿਹਾ ਹੈਗਾ ਹੈ ਨਾ ਹੁਣ ਆਪਾਂ ਹੁਣ ਮੂਹਰੇ ਬਰਸਾਤੀ ਮੌਸਮ ਆਉਣਾ ਹੈ ਨਾ ਮੌਨਸੂਨ ਜਿਹੜਾ ਸ਼ੁਰੂ ਹੋ ਜਾਣਾ ਹੈਗਾ ਹੈ ਨਾ ਅਤੇ ਆਪਾਂ ਕੀ ਕਰ ਸਕਦੇ ਹੈਗੇ ਜਿਵੇਂ ਮੰਨ ਲਓ ਤੁਸੀਂ ਹੈ ਨਾ ਆਹ ਵਾਲਾ ਪੌਦਾ ਹੈਗਾ ਜਿਹੜਾ ਕੀ ਕਹਿੰਦੇ ਹੁੰਦੇ ਆ ਕੋਈ ਵੀ ਪੌਦਾ ਚੱਕ ਲਓ ਚਾਹੇ ਤੁਸੀਂ ਮਨੀ ਪਲਾਂਟ ਲੈ ਲਓ ਜਾਂ ਕੁਮਾਰ ਦਾ ਪੌਦਾ ਹੋ ਗਿਆ ਹੈ ਨਾ ਅਤੇ ਜਿਹੜਾ ਅਰਜਨਟੀ ਆ ਹੋ ਗਿਆ ਨਿੰਬੂ ਦਾ ਪੌਦਾ ਹੋ ਗਿਆ ਠੀਕ ਹੈ ਅਤੇ ਤੁਲਸੀ ਕਹਿ ਲਓ ਤੁਸੀਂ ਪੁਦੀਨਾ ਕਹਿ ਲਓ ਹੈ ਨਾ ਇਹਨਾਂ ਦੀ ਆਪਾਂ ਕਟਿੰਗ ਕਰਕੇ ਕੀ ਹੈਗਾ ਕਟਿੰਗ ਕਰਕੇ ਇਹਨੂੰ ਕਿਸੇ ਹੋਰ ਉਹਦੇ ਵਿੱਚ ਤੁਸੀਂ ਗਮਲੇ ਦੇ ਵਿੱਚ ਛੋਟਾ ਜਿਹਾ ਆਪਾਂ ਕਰ ਸਕਦੇ ਹੈ ਨਾ ਫਿਰ ਉਹਨੂੰ ਲੋੜ ਮੁਤਾਬਿਕ ਹੈ ਨਾ ਧੁੱਪ ਹਵਾ ਅਤੇ ਜਿਹੜਾ ਪਾਣੀ ਉਹਦੀ ਵਰਤੋਂ ਕਰਕੇ ਹੈ ਨਾ ਉਹਨੂੰ ਵਧੀਆ ਵਧਾ ਸਕਦੇ ਆ ਹੈ ਨਾ ਜਿਵੇਂ ਮੈਂ ਕੀ ਹੈਗਾ ਜਿਵੇਂ ਮੈਂ ਘਰ ਹੈ ਨਾ ਇੱਕ ਛੋਟਾ ਜਿਹਾ ਇੱਕ ਟੁਕੜਾ ਸੀਗਾ ਉਹਦਾ ਐਲੋਵੀਰਾ ਦਾ ਕੁਮਾਰ ਕਹਿੰਦੇ ਹਾਂ ਜਿਹਨੂੰ ਆਪਾਂ ਅਤੇ ਉਹ ਕੁਮਾਰ ਦਾ ਜਿਹੜਾ ਨਾ ਇੱਕ ਛੋਟਾ ਟੁਕੜਾ ਮੈਂ ਕੱਟ ਕੇ ਲਗਾਇਆ ਸੀਗਾ ਉਹ ਕੈਂਚੀ ਨਾਲ ਤੁਸੀਂ ਕਿਸੇ ਨਾਲ ਵੀ ਕੱਟ ਸਕਦੇ ਚਾਕੂ ਲੈ ਲਿਓ ਜਾਂ ਕੁਛ ਵੀ ਉਹ ਕੱਟ ਕੇ ਕਿਵੇਂ ਜਦੋਂ ਆਪਾਂ ਜ਼ਮੀਨ 'ਚ ਉਗਾਉਂਦੇ ਤਾਂ ਉਦੋਂ ਨਾ ਬਾਹਲਾ ਵਧਦਾ ਫੁੱਲਦਾ ਜੇ ਕਟਿੰਗ ਕਰਦੇ ਹਾਂ ਆਪਾਂ ਕਟਿੰਗ ਨਾਲ ਕੀ ਹੈਗਾ ਜਿਹੜੇ ਉਹਨਾਂ ਦੀ ਜਿਵੇਂ ਆਪਣੇ ਸਰੀਰ ਦੇ ਵਿੱਚ ਕੀ ਹੁੰਦੇ ਹੈਗੇ ਆਪਾਂ ਮੰਨ ਲਓ ਹੈ ਨਾ ਜਿਵੇਂ ਆਪਾਂ ਸੈਰ ਕਰਦੇ ਹੈ ਨਾ ਆਪਣੇ ਕੀ ਆ ਸੈਰ ਕਰਨ ਨਾਲ ਆਪਣੇ ਪੁਰਾਣੇ ਸੈੱਲ ਖਤਮ ਹੁੰਦੇ ਆ ਡੈਡ ਹੁੰਦੇ ਤਾਂ ਨਵੇਂ ਸਾਲ ਬਣਦੇ ਆ ਹੈ ਨਾ ਉਸੇ ਤਰ੍ਹਾਂ ਹੀ ਪੌਦਿਆਂ ਦੇ ਵਿੱਚ ਵੀ ਹੁੰਦਾ ਜੇ ਇਹਨਾਂ ਦੀ ਨਾ ਆਪਾਂ ਕਟਿੰਗ ਕਰਦੇ ਹਾਂ ਤਾਂ ਉਹਨਾਂ ਦੀ ਨਵੀਂ ਗਰੋਥ ਸ਼ੁਰੂ ਹੁੰਦੀ ਹੈਗੀ ਠੀਕ ਹੈ ਤਾਂ ਇਹ ਇਸ ਦੇ ਨਾਲ ਕੀ ਹੈਗਾ ਉਹ ਜਿਹੜਾ ਪੌਦੇ ਉਹ ਵਧਦੇ ਫੁੱਲਦੇ ਜ਼ਿਆਦਾ ਨੇ ਇੱਕ ਇਹਨਾਂ ਨੂੰ ਹਵਾ ਅਤੇ ਜਿਹੜਾ ਉਹ ਨਾ ਧੁੱਪ ਉਹਨਾਂ ਨੂੰ ਬਰਾਬਰ ਦਵਾਉਣੀ ਚਾਹੀਦੀ ਆ ਐਂ ਨਹੀਂ ਹੈਗਾ ਵੀ ਤੁਸੀਂ ਛਾਵੇਂ ਰੱਖੋ ਜਾਂ ਫਿਰ ਧੁੱਪ 'ਚ ਹੀ ਰੱਖੋ ਅਤੇ ਇਸ ਤਰੀਕੇ ਨਾਲ ਕੀ ਹੈਗਾ ਵੀ ਆਪਾਂ ਜਿਹੜਾ ਵਧੀਆ ਆਪਾਂ ਹਰਿਆ ਭਰਿਆ ਜਿਹੜਾ ਖੁਸ਼ਹਾਲ ਓਹ ਆਪਾਂ ਜਿਹੜਾ ਵਧੀਆ ਗਰੀਨਰੀ ਹੈ ਨਾ ਗਾਰਡਨ ਤਿਆਰ ਕਰ ਸਕਦੇ ਹੈਗੇ ਪੌਦਾ ਤੁਸੀਂ ਕੋਈ ਵੀ ਲੈ ਲਓ ਉਹਦੀ ਜੇ ਕਟਿੰਗ ਪ੍ਰੋਪਰ ਤਰੀਕੇ ਨਾਲ ਕਰਨੀ ਆ ਆਪਾਂ ਕਟਿੰਗ ਕਰ ਗਏ ਆ ਨਾ ਉਹਨੂੰ ਟਾਈਮ ਟਾਈਮ ਨਾਲ ਕਟਿੰਗ ਕਰਕੇ ਉਹਦੇ ਅੱਗੇ ਅ ਉਹ ਕਰ ਰਹੇ ਹਾਂ ਤਾਂ ਉਹਦੀ ਓਨੀ ਜ਼ਿਆਦਾ ਕੀ ਆ ਵੱਧ ਹੁੰਦਾ ਹੈਗਾ